ਭੰਗੜੇ ਨਾਲ ਸੰਬੰਧਿਤ ਮੇਰੇ ਜੀਵਨ ਵਿੱਚ ਬਹੁਤ ਕਿੱਸੇ ਹਨ ਪਰ ਮੈਂ ਇੱਕ ਖਾਸ ਕਿੱਸਾ ਸ ਸਾਂਝਾ ਕਰਨਾ ਚਾਹੁੰਦਾ ਹਾਂ ਭੰਗੜੇ ਦੀ ਸ਼ੁਰੂਆਤ ਮੈਂ ਆਪਦੇ ਸ਼ੌਂਕ ਵਜੋਂ ਕੀਤੀ ਸੀ ਪਰ ਹੌਲੀ ਹੌਲੀ ਇਹ ਮੇਰਾ ਪੈਸ਼ਨ ਬਣ ਗਿਆ ਅਤੇ ਭੰਗੜੇ ਤੋਂ ਹੀ ਮੈਂ ਪਹਿਲੀ ਵਾਰ ਸਟੇਜ 'ਤੇ ਕੋਈ ਮੁਕਾਬਲਾ ਜਿੱਤਿਆ ਸੀ ਜਿਹੜਾ ਕਿ ਮੇਰੀ ਜ਼ਿੰਦਗੀ ਵਿੱਚ ਬਹੁਤ ਖਾਸ ਸੀ ਪਹਿਲੀ ਵਾਰ ਮੈਂ ਕਿਸੇ ਸਟੇਜ 'ਤੇ ਪ੍ਰਫੋਰਮੈਂਸ ਕੀਤੀ ਸੀ ਜਿਸ ਤੋਂ ਮੈਨੂੰ ਬਹੁਤ ਖੁਸ਼ੀ ਹੋਈ ਸੀ ਅਤੇ ਉਸ ਮੁਕਾਬਲੇ ਵਿੱਚ ਮੈਂ ਵਿਜੇਤਾ ਰਿਹਾ ਸੀ ਅਤੇ ਉਹ ਮੇਰੀ ਜ਼ਿੰਦਗੀ ਦਾ ਪਹਿਲਾ ਜਿਤ ਕੋਈ ਮੁਕਾਬਲਾ ਪਹਿਲਾ ਕੋਈ ਮੁਕਬਲਾ ਜਿੱਤਿਆ ਸੀ ਜਿਸ ਨਾਲ ਮੇਰੇ ਮਨ ਨੂੰ ਬਹੁਤ ਖੁਸ਼ੀ ਹੋਈ ਸੀ